ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਮੀਸ਼ੋ ਐਪ ਤੋਂ ਦੋ ਕੌਫੀ ਮੱਗ ਹਫ਼ਤਾ ਪਹਿਲਾਂ ਔਡਰ ਕੀਤੇ ਸੀ ਜੋ ਕਿ ਬਹੁਤ ਹੀ ਵਧੀਆ ਕੁਆਲਿਟੀ ਦੇ ਨੇ ਅਤੇ ਕਾਫ਼ੀ ਮਹਿੰਗੇ ਵੀ ਸੀ ਮੈਨੂੰ ਮੇਰਾ ਔਡਰ ਅੱਜ ਹੀ ਮਿਲਿਆ ਅਤੇ ਜਦੋਂ ਮੈਂ ਉਹਦੀ ਪੈਕਿੰਗ ਖੋਲ੍ਹੀ ਤਾਂ ਪਹਿਲਾਂ ਤਾਂ ਪੈਕਿੰਗ ਹੀ ਬਹੁਤ ਘਟੀਆ ਢੰਗ ਨਾਲ ਕੀਤੀ ਹੋਈ ਆ ਅਤੇ ਜੇ ਇਸ ਹਿਸਾਬ ਨਾਲ ਮੱਗ ਦੀ ਕੁਆਲਿਟੀ ਆ ਪੈਕਿੰਗ ਵੀ ਉਹਦੀ ਬਹੁਤ ਹੀ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਸੀ ਅਤੇ ਜਿਸ ਕਰਕੇ ਮੈਂ ਪਾਰਸਲ ਜਿਹੜਾ ਆ ਉਹ ਡਿਲੀਵਰੀ ਵਾਲੇ ਦੇ ਸਾਹਮਣੇ ਹੀ ਖੋਲ੍ਹਿਆ ਜਿਹੜਾ ਤੁਸੀਂ ਭੇਜਿਆ ਅਤੇ ਉਸ ਨੂੰ ਦਿਖਾਇਆ ਕਿ ਪੈਕਿੰਗ ਬਹੁਤ ਹੀ ਰੱਦੀ ਢੰਗ ਨਾਲ ਕੀਤੀ ਗਈ ਆ ਜਦੋਂ ਮੈਂ ਪੈਕਿੰਗ ਖੋਲ੍ਹੀ ਤਾਂ ਅੰਦਰ ਦੇਖਿਆ ਕਿ ਕੌਫੀ ਮੱਗ ਵੀ ਟੁੱਟੇ ਹੋਏ ਸੀ ਜਿਸ ਕਰਕੇ ਮੇਰਾ ਮਨ ਬਹੁਤ ਹੀ ਖਰਾਬ ਹੋਇਆ ਦੇਖ ਕੇ ਕਿ ਪਹਿਲਾਂ ਤਾਂ ਉਹਦੀ ਪੈਕਿੰਗ ਹੀ ਚੰਗੀ ਤਰੀਕੇ ਨਾਲ ਨਹੀਂ ਕੀਤੀ ਅਤੇ ਉੱਤੋਂ ਫਿਰ ਕੌਫੀ ਮੱਗ ਵੀ ਟੁੱਟੇ ਹੋਏ ਨੇ ਅਤੇ ਮੇਰਾ ਖਿਆਲ ਹੈ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਆ ਅਤੇ ਮੈਂ ਕੌਫੀ ਮੱਗ ਜਿਹੜੇ ਆ ਉਹ ਬਹੁਤ ਹੀ ਸ਼ੌਂਕ ਨਾਲ ਮੰਗਵਾਏ ਸੀ ਅਤੇ ਮੈਂ ਕਾਫ਼ੀ ਦੇਰ ਇਹਨਾਂ ਦੀ ਵੇਟ ਕਰਦੀ ਪਈ ਸੀ ਅਤੇ ਮੈਨੂੰ ਤਾਂ ਅੱਜ ਪਾਰਸਲ ਮਿਲਿਆ ਆ ਤਾਂ ਉਹ ਵੀ ਇੰਨੀ ਬੁਰੀ ਹਾਲਤ 'ਚ ਅਤੇ ਮੇਰੀ ਬਸ ਇੱਕ ਹੀ ਬੇਨਤੀ ਆ ਕਿ ਜਾਂ ਤਾਂ ਤੁਸੀਂ ਇਹ ਕੌਫੀ ਮੱਗ ਬਦਲ ਕੇ ਮੈਨੂੰ ਇਹਦੀ ਜਗ੍ਹਾ ਨਵੇਂ ਦੇ ਦਿਓ ਅਤੇ ਜਾਂ ਫਿਰ ਮੈਨੂੰ ਇਹਦਾ ਰਿਫੰਡ ਵਾਪਿਸ ਕੀਤਾ ਜਾਵੇ